ਅੱਜ ਦੇ ਜਮਾਨੇ ਵਿੱਚ ਬਿਜਲੀ ਦਾ ਰੋਜ਼ੀ ਰੋਟੀ 'ਤੇ ਕਾਫ਼ੀ ਪ੍ਰਭਾਵ ਹੈ ਜਿਵੇਂ ਆਪਾਂ ਵੇਖ ਸਕਦੇ ਹਾਂ ਦਫਤਰਾਂ ਵਿੱਚ ਕੰਪਿਊਟਰ ਕੈਫ਼ੇ ਵਿੱਚ ਤਾਂ ਵਰਕਸ਼ੋਪ ਵਿੱਚ ਜਿੱਥੇ ਗਰਾਇਡਿੰਗ ਵੈਲਡਿੰਗ ਕਟਿੰਗ ਵਗੈਰਾ ਕੀਤੀ ਜਾਂਦੀ ਹੈ ਉੱਥੇ ਸਭ ਬਿਜਲੀ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਬਿਜਲੀ ਦੇ ਕੱਟ ਦੌਰਾਨ ਇਹਨਾਂ 'ਤੇ ਕਾਫ਼ੀ ਪ੍ਰਭਾਵ ਪੈਂਦਾ ਹੈ ਕਿਉਂਕਿ ਇਹ ਸਭ ਮਸ਼ੀਨਾਂ ਬਿਨਾਂ ਬਿਜਲੀ ਦੇ ਨਹੀਂ ਚਲਾਈ ਜਾ ਸਕਦੀ ਹੁਣ ਜਿਦਾਂ ਕੱਟ ਦੇ ਦੌਰਾਨ ਆਪਾਂ ਛੋਟੇ ਮੋਟੇ ਘਰਾਂ ਵਿੱਚ ਤਾਂ ਰੋਸ਼ਨੀ ਕਰ ਸਕਦੇ ਹਾਂ ਇਨਵਰਟਰ ਦੀ ਵਰਤੋਂ ਨਾਲ ਬਟ ਪਰ ਇਹ ਵੱਡੀ ਫੈਕਟਰੀਆਂ ਕੈਫੇ 'ਤੇ ਵਰਕਸ਼ੋਪ ਵਿੱਚ ਇਨਵਰਟਰ ਨਾਲ ਨਹੀਂ ਕੀਤੀ ਜਾ ਸਕਦੀ ਕਿਉਂਕਿ ਉੱਥੇ ਲੋਡ ਕਾਫ਼ੀ ਜ਼ਿਆਦਾ ਹੁੰਦਾ ਹੈ ਇਸ ਲਈ ਬਿਜਲੀ ਦੇ ਕੱਟ ਨਾਲ ਇਹਨਾਂ 'ਤੇ ਕਾਫ਼ੀ ਪ੍ਰਭਾਵ ਪੈਂਦਾ ਹੈ